ਮੈਨੂੰ ਪੰਜਾਬੀ ਅਤੇ ਹਿੰਦੀ ਗੀਤ ਸੁਣਨਾ ਬਹੁਤ ਪਸੰਦ ਹੈ ਮੈਨੂੰ ਸੁਣਨ ਦੇ ਨਾਲ ਨਾਲ ਗਾਉਣ ਦਾ ਵੀ ਬਹੁਤ ਸ਼ੌਂਕ ਹੈ ਮੈਂ ਸੱਭਿਅਕ ਅਤੇ ਧਾਰਮਿਕ ਗੀਤ ਸੁਣਨਾ ਬਹੁਤ ਪਸੰਦ ਕਰਦਾ ਹਾਂ ਇਹਨਾ ਵਿੱਚੋਂ ਜਿਵੇਂ ਗੁਰਦਾਸ ਮਾਨ ਜੀ ਦਾ ਕਹਿਣਾ ਹੈ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਬਾਕੀ ਦੇ ਕੰਮ ਛੱਡੋ ਪਹਿਲਾਂ ਸਿਹਤ ਜ਼ਰੂਰੀ ਹੈ ਹਿੰਦੀ ਗੀਤਾਂ ਵਿੱਚ ਲਤਾ ਮੰਗੇਸ਼ਕਰ ਦੇ ਐ ਵਤਨ ਕੇ ਲੋਗੋ ਜ਼ਰਾ ਯਾਦ ਕਰੋ ਕੁਰਬਾਨੀ ਮੈਂ ਫਰੀ ਟਾਈਮ ਵਿਚ ਗਾਣੇ ਸੁਣਦਾ ਹਾਂ ਅਤੇ ਡਰਾਈਵਿੰਗ ਕਰਦੇ ਸਮੇਂ ਵੀ ਸੁਣਦਾ ਹਾਂ ਅਤੇ ਬਹੁਤ ਹੀ ਵਧੀਆ ਲੱਗਦਾ ਹੈ